ਮੈਂ ਇੱਕ ਟੂਰਨਾਮੈਂਟ ਖੇਡਣ ਵਾਸਤੇ ਅਸਾਮ ਵਿੱਚ ਗਿਆ ਸੀ ਜਿੱਥੇ ਕਿ ਲੋਕ ਅਸਾਮ ਦੀ ਭਾਸ਼ਾ ਬੋਲਦੇ ਆ ਅਤੇ ਉੱਥੇ ਦੇ ਲੋਕ ਹਿੰਦੀ ਵੀ ਸਹੀ ਤਰੀਕੇ ਨਾਲ ਨਹੀਂ ਬੋਲਦੇ ਅਤੇ ਇੰਗਲਿਸ਼ ਠੀਕ ਬੋਲਦੇ ਆ ਅਤੇ ਕਹਿ ਲਓ ਇੰਗਲਿਸ਼ ਸਾਡੀ ਫਿਰ ਇੱਡੀ ਵਧੀਆ ਨਹੀਂ ਸੀ ਜਿਸ ਕਰਕੇ ਸਾਨੂੰ ਆਪਸੀ ਕਹਿ ਲਓ ਕਮਿਊਨੀਕੇਸ਼ਨ ਕਰਨ ਨੂੰ ਬਹੁਤ ਦਿੱਕਤਾਂ ਆ ਰਹੀਆਂ ਸੀ ਅਤੇ ਫਿਰ ਮੈਂ ਉਸ ਟਾਈਮ ਦੇ ਵਿੱਚ ਗੂਗਲ ਟਰਾਂਸਲੇਟ ਦੀ ਵਰਤੋਂ ਕੀਤੀ ਜਿਹਨੇ ਕਹਿ ਲਓ ਕਿ ਮੇਰੇ ਹਰ ਗੱਲ ਨੂੰ ਉਹ ਇਜ਼ੀਲੀ ਦੱਸਦਾ ਸੀਗਾ ਮੈਂ ਆਪਣੇ ਵਾਲੇ 'ਚੋਂ ਬੋਲਦਾ ਸੀ ਉੱਧਰ ਮੈਂ ਸੁਣਾ ਦਿੰਦਾ ਸੀ ਉਹ ਸਮਝਦਾ ਸੀ ਮੇਰੀ ਗੱਲ ਨੂੰ ਅਤੇ ਉਸ ਤਰੀਕੇ ਨਾਲ ਉਹ ਵੀ ਉੱਧਰਲੀ ਆਸਾਮੀ ਦੇ ਵਿੱਚ ਬੋਲਦੇ ਸੀ ਅਤੇ ਹਿੰਦੀ ਪੰਜਾਬੀ ਦੇ ਵਿੱਚ ਉਹ ਕਨਵਰਟ ਕਰ ਦਿੰਦਾ ਸੀਗਾ ਜੋ ਕਿ ਅੱਜ ਦੇ ਜਿਹੜਾ ਯੁੱਗ ਆ ਇੱਕ ਟੈਕਨੋਲੋਜੀ ਦਾ ਉਹਦਾ ਲੱਗਦਾ ਕਿ ਬਹੁਤ ਵੱਡਾ ਰੋਲ ਆ ਸਾਡੀ ਜ਼ਿੰਦਗੀ ਵਿੱਚ ਸਾਡੀ ਜ਼ਿੰਦਗੀ ਨੂੰ ਬੜਾ ਸੌਖਾ ਬਣਾ ਤਾਂ ਇਹਨਾਂ ਨੇ ਜੇ ਮੈਨੂੰ ਲੱਗਦਾ ਕਿ ਇਹ ਚੀਜ਼ ਨਾ ਹੁੰਦੇ ਤਾਂ ਸ਼ਾਇਦ ਮੇਰੇ ਲਈ ਔਖਾ ਹੋ ਜਾਣਾ ਸੀਗਾ ਅਤੇ ਇਹ ਮੇਰੇ ਲਈ ਬਹੁਤ ਵਧੀਆ ਸੁਵਿਧਾਜਨਕ ਰਿਹਾ ਕਿਉਂਕਿ ਮੈਂ ਉੱਥੇ ਜਾ ਕੇ ਭਾਵੇਂ ਬੱਸ ਫੜਨੀ ਸੀ ਜਾਂ ਕਿਤੇ ਆਉਣਾ ਜਾਣਾ ਸੀ ਕਿਸੇ ਥਾਂ ਦਾ ਨਾਮ ਵੀ ਸੀਗਾ ਉਹ ਮਤਲਬ ਕਹਿ ਲਓ ਕਿ ਉੱਥੇ ਬੋਲਦਾ ਅਤੇ ਲੋਕ ਸਮਝ ਜਾਂਦੇ ਸੀ ਵੈਸੇ ਜੇ ਮੈਂ ਉਹਨੂੰ ਬੋਲਾਂ ਕਿ ਮੈਂ ਉੱਥੇ ਕੀ ਕਹਿੰਦੇ ਉਹਨੂੰ ਕਿਸੇ ਵੀ ਸ਼ਾਇਦ ਨਾਮ ਲੈ ਲਓ ਉੱਥੇ ਆਪਾਂ ਜਾਣਾ ਹੋਵੇ ਆਪਣੇ ਡਿਸਟ੍ਰਿਕ ਦੇ ਵਿੱਚ ਅਤੇ ਉਹ ਨਹੀਂ ਸਮਝ ਪਾ ਰਹੇ ਲੋਕ ਜਦੋਂ ਬਟ ਮੈਂ ਬੋਲਦਾ ਸੀ ਉਦੋਂ ਆਸਾਮੀ ਵਿੱਚ ਕਨਵਰਟ ਕਰ ਦਿੰਦਾ ਸੀਗਾ ਅਤੇ ਉਹ ਬਹੁਤ ਜਲਦੀ ਸਮਝ ਜਾਂਦੇ ਸੀਗੇ ਇਸ ਕਰਕੇ ਇਹਦਾ ਸਾਨੂੰ ਬਹੁਤ ਸੁਵਿਧਾ ਦਾ ਹੋਇਆ ਹੈ